ਸਤਿ ਸ਼੍ਰੀ ਅਕਾਲ ਮੇਰਾ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੇ ਘਰ ਮੇਰੇ ਮੌਤ ਹੋਣ ਕਾਰਨ ਮੈਂ ਆਪਣਾ ਆਧਾਰ ਕਾਰਡ ਅਪਡੇਟ ਕਰਾਉਣਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਕੀ ਕੀ ਵਰਤ ਇਸ ਵਿੱਚ ਵਰਤ ਸਕਦਾ ਹਾਂ ਜਿਵੇਂ ਕਿ ਮੈਨੂੰ ਕਿਸੇ ਵੀ ਫੋਟੋਆਂ ਜਾਂ ਕਿਸੇ ਆਧਾਰ ਕਾਰਡ ਦੀ ਫੋਟੋ ਕਾਪੀ ਬੈਂਕ ਕਾਪੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚੀਜ਼ ਦੀ ਲੋੜ ਹੈ ਤਾਂ ਤੁਸੀਂ ਮੈਨੂੰ ਮੇਰੇ ਏ ਏਟ ਪੰਜ ਫਾਈਵ ਫਾਈਵ ਥ੍ਰੀ ਟੂ ਸਿਕਸ ਨਾਈਨ ਏਟ 'ਤੇ ਫੋਨ ਕਰਕੇ ਕਾਲ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਨੂੰ ਕੀ ਕੀ ਜ਼ਰੂਰੀ ਚਾਹੀਦਾ ਹੈ ਇਸ ਰਾ ਇਸ ਨਾਲ ਹੀ ਮੈਂ ਤੁਹਾਨੂੰ ਬੁਹਾ ਬਹੁਤ ਚੀਜ਼ਾਂ ਤੁਹਾਨੂੰ ਦੇ ਸਕਦਾ ਹਾਂ ਤਾਂ ਕਿ ਜੋ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤੁਸੀਂ ਮੇਰੀ ਅਪਡੇਟ ਮੇਰੇ ਮੌਤ ਘਰ ਵਿੱਚ ਮੌਤ ਹੋ ਜਾਣ ਕਾਰਨ ਮੈਂ ਇਹ ਬਹੁਤ ਹੀ ਦੁਖੀ ਹਾਂ ਜਿਸ ਕਾਰਨ ਮੈਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਾ ਪਾਇਆ ਪਰ ਮੈਂ ਹੁਣ ਕਰਵਾਉਣਾ ਚਾਹੁੰਦਾ ਹਾਂ ਤੂੰ ਤੁਸੀਂ ਕਿਰਪਾ ਕਰਕੇ ਮੈਨੂੰ ਜ਼ਰੂਰੀ ਕਾਲ ਕਰਿਓ ਅਤੇ ਮੈਨੂੰ ਦੱਸਿਓ ਕਿ ਮੈਨੂੰ ਕੀ ਕੀ ਲੋੜ ਹੈ ਮੈਂ ਤੁਹਾਡੇ ਅੱਗੇ ਬਹੁਤ ਹੀ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਹੀ ਰੱਖਦਾ ਹਾਂ ਕਿ ਤੁਸੀਂ ਜ਼ਰੂਰ ਮੈਨੂੰ ਮੈਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਇਹ ਸਫਲ ਪੂਰਵਕ ਹੋਵੋਗੇ ਆਪ ਜੀ ਦੇ ਬਹੁਤ ਹੀ ਆਗਿਆਕਾਰੀ ਹੋਵਾਂਗਾ ਮੈਂ ਧੰਨਵਾਦ ਹੋਰ ਜੇ ਕੋਈ ਮੈਨੂੰ ਕੋਈ ਵੀ ਸਮੱਸਿਆ ਹੋਵੇਗੀ ਤਾਂ ਮੈਂ ਆਪ ਨੂੰ ਇਸ ਨੰਬਰ 'ਤੇ ਫੋਨ ਕਰਕੇ ਆਪ ਜੀ ਕੋਲੋਂ ਹੋਰ ਵੀ ਪੁੱਛ ਸਕਦਾ ਹਾਂ ਬਾਕੀ ਹੋਰ ਮੇਰਾ ਆਧਾਰ ਕਾਰਡ ਅਪਡੇਟ ਕਰਵਾਉਣ ਵੇ ਮੈਨੂੰ ਬਹੁਤ ਲੋੜ ਹੈ ਮੈਂ ਬਾਹਰ ਦਾ ਵੀਜ਼ਾ ਆ ਰਿਹਾ ਸੀ ਤਾਂ ਪਾਸਪੋਰਟ ਅਪਲਾਈ ਕਰਨਾ ਸੀ ਮੈਂ ਬਾਹਰ ਦਾ ਪਾਸਪੋਰਟ ਅਪਲਾਈ ਕਰਨਾ ਸੀ ਤਾਂ ਬਹੁਤ ਮੈਨੂੰ ਦੱਸ ਰਹੇ ਸੀ ਕਿ ਤੁਹਾਡੇ ਅਧਾਰ ਕਾਰਡ ਦੀ ਫੋਟੋ ਅਪਡੇਟ ਹੋਣ ਤੁਹਾਡਾ ਆਧਾਰ ਕਾਰਡ ਅਪਡੇਟ ਹੋਣ ਵਾਲਾ ਹੈ ਅਤੇ ਇਹ ਕਰਵਾਉਣਾ ਬਹੁਤ ਜ਼ਰੂਰੀ ਹੈ ਜਿਸ ਜੇ ਮੈਂ ਇਹ ਨਾ ਕਰਵਾ ਪਾਇਆ ਕਰ ਪਾਇਆ ਤਾਂ ਮੈਨੂੰ ਬਹੁਤ ਹੀ ਲੇਟ ਆਪਣਾ ਪਾਸਪੋਰਟ ਮਿਲੇਗਾ